ਹਾਂਜੀ ਅੱਜ ਆਪਾਂ ਗੱਲ ਕਰਦੇ ਹਾਂ ਟੈਕਨੋਲਜੀ ਬਾਰੇ ਟੈਕਨੋਲਜੀ ਦੇ ਵਿੱਚ ਕਾਫ਼ੀ ਟੈਕਨੋਲਜੀ ਆ ਜਾਂਦੀ ਹੈ ਟੈਕਨੋਲਜੀ ਇਕੱਲੀ ਇੱਕ ਟੈਕਨੋਲਜੀ ਨਹੀਂ ਹੈਗੀ ਇਹ ਵੀ ਬਹੁਤ ਟੈਕਨੋਲੋਜੀਆਂ ਨੇ ਇਹਦੇ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਹੋ ਗਈ ਆਰਟੀਫਿਸ਼ਅਲ ਇੰਟੈਲੀਜੈਂਸ ਹੋ ਗਈ ਕਾਫ਼ੀ ਟੈਕਨੋਲਜੀਆਂ ਨੇ ਜਿਹੜੀਆਂ ਮਤਲਬ ਅਲੱਗ ਅਲੱਗ ਤਰ ਤਰੀਕੇ ਨਾਲ ਅਲੱਗ ਅਲੱਗ ਕੰਮ ਕਰਦੀਆਂ ਨੇਗੀਆ ਇਹਦੇ ਵਿੱਚ ਕੀ ਹੁੰਦਾ ਮੈਂ ਅੱਜ ਤੁਹਾਡੇ ਨਾਲ ਏ ਆਈ ਟੈਕਨੋਲਜੀ ਬਾਰੇ ਗੱਲ ਕਰੂੰਗਾ ਆਈ ਟੀ ਹੈ ਜੋ ਵੀ ਏ ਆਈ ਟੈਕਨੋਲਜੀ ਹੈ ਉਹ ਆਈ ਟੀ ਦਾ ਹੀ ਇੱਕ ਪਾਰਟ ਹੈਗਾ ਗਾ ਆਰਟੀਫਿਸ਼ਅਲ ਇੰਟੈਲੀਜੈਂਸ ਟੈਕਨੋਲੋਜੀ ਕੀ ਹੈ ਮਤਲਬ ਕਿਸੇ ਵੀ ਕੰਮ ਨੂੰ ਸੌਖੇ ਤਰੀਕੇ ਨਾਲ ਕਰਨਾ ਕੋਈ ਵੀ ਔਖਾ ਕੰਮ ਆ ਉਹਨੂੰ ਆਪਾਂ ਸੌਖੇ ਤਰੀਕੇ ਨਾਲ ਕਿਵੇਂ ਕਰ ਸਕਦੇ ਹਾਂ ਪਰ ਇਹ ਅੱਜ ਦੀ ਮਨੁੱਖ ਲਈ ਜ਼ਰੂਰੀ ਹੋ ਚੁੱਕਿਆ ਅਲੱਗ ਅਲੱਗ ਕੰਪਨੀਆਂ ਅਲੱਗ ਅਲੱਗ ਫਰਮ ਇਹ ਟੈਕਨੋਲਜੀ ਦਾ ਮਤਲਬ ਉਹ ਕਰ ਰਹੀਆਂ ਡਿਵੈਲਪ ਕਰ ਰਹੀਆਂ ਟੈਕਨੋਲਜੀ ਨੂੰ ਵੀ ਕਿਵੇਂ ਕੰਮ ਨੂੰ ਸੌਖਾ ਬਣਾਇਆ ਜਾ ਸਕੇ ਕਿਵੇਂ ਇੱਕ ਜਗ੍ਹਾ ਦੀ ਮੈਨਪਾਵਰ ਨੂੰ ਘੱਟ ਕੀਤਾ ਜਾ ਸਕਦਾ ਜਿੱਥੇ ਸੌ ਬੰਦਾ ਕੰਮ ਕਰਦਾ ਉੱਥੇ ਸੌ ਬੰਦੇ ਦੀ ਜਗ੍ਹਾ ਪੰਜਾਹ ਬੰਦੇ ਨੂੰ ਟੈਕਨੋਲਜੀ ਥਰੂ ਕੰਮ ਦੇ ਕੇ ਪੰਜਾਹ ਬੰਦਿਆਂ ਤੋਂ ਕਿਵੇਂ ਕੰਮ ਲਿਆ ਜਾ ਸਕਦਾ ਅੱਜ ਦੇ ਜ਼ਮਾਨੇ ਵਿੱਚ ਇਹ ਟੈਕਨੋਲਜੀ ਹਰ ਇੱਕ ਲਈ ਜ਼ਰੂਰੀ ਹੈ ਚਾਹੇ ਉਹ ਪੜ੍ਹਿਆ ਲਿਖਿਆ ਚਾਹੇ ਅਨਪੜ੍ਹ ਹੈ ਹੁਣ ਆਪਾਂ ਇਹਦੇ ਲਈ ਦੇਖ ਸਕਦੇ ਹਾਂ ਜਿਵੇਂ ਏਅਰਪੋਰਟਾਂ 'ਤੇ ਹਵਾਈ ਹ ਏਅਰਪੋਰਟਸ ਹੋ ਗਏ ਬੱਸ ਸਟੈਂਡਸ ਹੋ ਗਏ ਕੋਈ ਵੀ ਵੀਜ਼ਾ ਸੈਂਟਰ ਹੋ ਗਏ ਅਲੱਗ ਅਲੱਗ ਕੋਈ ਇੰਸਟੀਟਿਊਟ ਹੋ ਗਏ ਉੱਥੇ ਸਾਰਿਆਂ 'ਤੇ ਏ ਆਈ ਟੈਕਨੋਲਜੀ ਯੂਜ ਕੀਤੀ ਜਾਂਦੀ ਹੈ ਏ ਆਈ ਮਤਲਬ ਇੰਟਰਨੈਟ ਦੇ ਸੋ ਕਾਫ਼ੀ ਲੋਕ ਗਿਆਨ ਇਕੱਠਾ ਕਰ ਰਹੇ ਨੇ ਆਪਣਾ ਇਸ ਚੀਜ਼ ਦੇ ਵਿੱਚ ਪਰ ਇਹ ਟੈਕਨੋਲਜੀਜ ਅੱਜ ਕੱਲ੍ਹ ਦੇ ਸਕੂਲ ਕਾਲਜ ਦੇ ਬੱਚੇ ਏ ਆਈ ਬਾਰੇ ਹੀ ਪੜ੍ਹ ਰਹੇ ਹਨ ਇਹਦੇ ਰਾਹੀਂ ਉਹਨਾਂ ਨੂੰ ਕਾਫ਼ੀ ਮਤਲਬ ਸਿੱਖਣ ਨੂੰ ਮਿਲਦਾ ਹੈ ਬਹੁਤ ਬੱਚੇ ਇਹੋ ਜਿਹੇ ਹੁੰਦੇ ਹੈਗੇ ਜਿਹੜੇ ਆਪਣੇ ਘਰਾਂ ਦੇ ਵਿੱਚ ਹੀ ਤਿਆਰੀ ਕਰਨ ਦੇ ਲਈ ਮਜ਼ਬੂਰ ਹੁੰਦੇ ਹਨ ਉਹ ਬਾਹਰ ਕਿਸੇ ਯੂਨੀਵਰਸਿਟੀ ਕਾਲਜ ਦੇ ਵਿੱਚ ਨਹੀਂ ਜਾ ਸਕਦੇ ਤਾਂ ਏ ਆਈ ਟੈਕਨੋਲਜੀ ਇਸ ਹਿਸਾਬ ਨਾਲ ਡਿਵੈਲਪ ਕੀਤੀ ਗਈ ਹੈ ਕਿ ਜੋ ਵੀ ਬੱਚਾ ਹੈਗਾ ਉਹ ਆਪਣੇ ਘਰ ਤੋਂ ਵੀ ਕੁਛ ਬਣ ਸਕਦਾ ਹੈ ਏ ਆਈ ਟੈਕਨੋਲਜੀ ਸਾਰਿਆਂ ਲਈ ਸੇਮ ਹੈ ਇਸ ਦੇ ਲਈ ਕੋਈ ਵੀ ਗਰੀਬ ਜਾ ਅਮੀਰ ਨਹੀਂ ਹੈ ਕੋਈ ਵੀ ਕੁਛ ਕੁਛ ਕੁ ਪੈਸੇ ਭਰ ਕੇ ਇਸ ਟੈਕਨੋਲਜੀ ਦਾ ਲਾਭ ਲੈ ਸਕਦਾ ਹੈ ਇਹ ਟੈਕਨੋਲਜੀ ਦੇ ਥਰੂ ਕਾਫ਼ੀ ਬੱਚੇ ਵਧੀਆ ਅਫ਼ਸਰ ਵੀ ਲੱਗ ਗਏ ਹਨ ਮਤਲਬ ਕੋਈ ਆਈ ਟੀ ਆਈ ਕਰਕੇ ਇੰਜੀਨੀਅਰ ਲੱਗ ਜਾਂਦਾ ਹੈ ਕੋਈ ਡਾਕਟਰ ਦੀ ਪੜ੍ਹਾਈ ਕਰਕੇ ਕੁਛ ਲੱਗ ਜਾਂਦਾ ਹੈ ਇਸ ਟੈਕਨ ਇਹ ਟੈਕਨੋਲਜੀ ਆਉਣ ਵਾਲੇ ਸਮੇਂ ਵਿੱਚ ਕਾਫ਼ੀ ਲਾਭਦਾਇਕ ਹੋਵੇਗੀ ਅਤੇ ਹਰ ਇੱਕ ਨੂੰ ਇਸ ਟੈਕਨੋਲੋਜੀ ਨਾਲ ਜੁੜਨਾ ਚਾਹੀਦਾ ਹੈ